ਮੈਂ ਇਹੀ ਸੋਚਦੀ ਹਾਂ ਕਿ ਸਿੱਖਿਅਤ ਵਿਅਕਤੀ ਚੰਗੇ ਵਿਵਹਾਰ ਅਤੇ ਸਿਧਾਂਤਾ ਦੀ ਪਾਲਣਾ ਬਿਲਕੁਲ ਕਰਦਾ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਕਿੱਥੇ ਕਿਸ ਤਰ੍ਹਾਂ ਬੋਲਣਾ ਹੈ ਕਿਸ ਤਰ੍ਹਾਂ ਬਿਹੇਵ ਕਰਨਾ ਆ ਕਿ ਇੱਕ ਪੜ੍ਹਿਆ ਲਿਖਿਆ ਇਨਸਾਨ ਹਮੇਸ਼ਾ ਆਪਣਾ ਬੈਸਟ ਦਿੰਦਾ ਹੈ ਕਿ ਆਪਣੀ ਆਪਣੀ ਗੈਸਚਰਸ ਆਪਣੇ ਹਰ ਚੀਜ਼ ਦਾ ਧਿਆਨ ਰੱਖਦਾ ਹੈ ਕਿ ਮੈਂ ਉਹਨੂੰ ਲਾਉਣ ਦਾ ਪਤਾ ਹੁੰਦਾ ਹੈ ਸੁਸਾਇਟੀ 'ਚ ਕਿਵੇਂ ਵੋਕ ਕਰਨੀ ਕਿਵੇਂ ਟੋਕ ਕਰਨੀ ਹੈ ਇਹੀ ਉਹਦੀ ਮੇਨ ਚੀਜ਼ ਹੁੰਦੀ ਹੈ ਪੜ੍ਹਾਈ ਬੰਦੇ ਨੂੰ ਬਹੁਤ ਅੱਗੇ ਤੱਕ ਲੈ ਕੇ ਜਾ ਸਕਦੀ ਹੈ ਬੰਦੇ ਦਾ ਚੰਗਾ ਵਿਵਹਾਰ ਹੀ ਉਹਨੂੰ ਅੱਗੇ ਉਹਦੀ ਪਹਿਚਾਣ ਵਧਾਉਂਦਾ ਹੈ ਅਤੇ ਜੋ ਕਿ ਪੜ੍ਹਿਆ ਲਿਖਿਆ ਇਨਸਾਨ ਆ ਮੇਰੇ ਹਿਸਾਬ ਨਾਲ ਤਾਂ ਉਹਨੂੰ ਸਾਰਾ ਰੂਲਸ ਐਂਡ ਰੈਗੁਲੇਸ਼ਨਸ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਹਰ ਇੱਕ ਚੀਜ਼ ਦਾ ਉਹਨੂੰ ਪਤਾ ਹੁੰਦਾ ਹੈ ਕਿ ਮੈਂ ਸੁਸਾਇਟੀ 'ਚ ਅਗਰ ਸਰਵਾਈਵ ਕਰਨਾ ਹੈ ਅਤੇ ਕਿਵੇਂ ਸਰਵਾਈਵ ਕਰਨਾ ਆ ਕਿਵੇਂ ਕਿਸੇ ਨਾਲ ਗੱਲ ਕਰਨੀ ਕਿਸੇ ਨਾਲ ਕਿਵੇਂ ਬਿਹੇਵ ਕਰਨਾ ਆ ਕੁਛ ਲੋਕ ਹੁੰਦੇ ਨੇ ਨਾ ਸਮਝ ਜੋ ਕਿ ਪੜ੍ਹੇ ਲਿਖੇ ਹੋ ਕੇ ਵੀ ਕੁਝ ਬੇਵਕੂਫੀਆਂ ਕਰ ਜਾਂਦੇ ਨੇ ਨਾ ਸਮਝੀ ਦੇ ਤੌਰ 'ਤੇ ਜਿਵੇਂ ਕਿ ਕੁਝ ਪੜ੍ਹੇ ਲਿਖੇ ਵਿਅਕਤੀ ਵੀ ਟ੍ਰੈਫ਼ਿਕ ਰੂਲਸ ਜਿਵੇਂ ਕਿ ਕੋਈ ਫੋਲੋ ਨਹੀਂ ਕਰਦਾ ਸਭ ਕੁਛ ਪਤਾ ਹੈ ਕਿ ਇਹ ਬੇਸਿਕ ਰੂਲਸ ਐਂਡ ਰੈਗੂਲੇਸ਼ਨਸ ਨੇ ਜੋ ਕਿ ਹਰ ਇੱਕ ਅ ਬੰਦੇ ਨੂੰ ਫੋਲੋ ਕਰਨੇ ਚਾਹੀਦੇ ਨੇ ਜੋ ਕਿ ਗਵਰਮੈਂਟ ਨੇ ਸਾਡੀ ਭਲਾਈ ਵਾਸਤੇ ਬਣਾਏ ਹੋਏ ਨੇ ਅਤੇ ਸਾਨੂੰ ਉਨ੍ਹਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਬਟ ਕੁਛ ਲੋਕ ਆਪਣੀ ਨਾ ਸਮਝੀ ਦੇ ਤੌਰ 'ਤੇ ਇਹਨੂੰ ਨਹੀਂ ਫੋਲੋ ਕਰਦੇ ਫਿਰ ਉਹ ਨਾ ਸਮ ਬੇਵਕੂਫ ਵਾਲੀ ਕੈਟਾਗੀਰੀ 'ਚ ਆ ਜਾਂਦੇ